ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਕਰੂੰਗਾ ਜੀ ਮੈਂ ਦੇਖਦਾ ਹਾਂਜੀ ਹਾਂਜੀ ਮੈਂ ਪੁੱਛੂਗਾ ਕਿਸੇ ਕੋਲੋਂ ਮੈਂ ਆਪਣੇ ਦੋਸਤਾਂ ਕੋਲੋਂ ਜਾਂ ਕੋਈ ਰਿਸ਼ਤੇਦਾਰਾਂ ਤੋਂ ਪੁੱਛ ਕੇ ਕੋਈ ਗੱਲ ਨਹੀਂ ਮੈਂ ਜ਼ਰੂਰ ਮਦਦ ਕਰੂੰਗਾ ਤੁਹਾਡੀ ਅਤੇ ਹਾਂਜੀ ਹਾਂਜੀ ਨਹੀ ਨਹੀ ਕੋਈ ਗੱਲ ਨਹੀਂ ਤੁਹਾਨੂੰ ਕਿੰਨੇ ਟਾਈਮ ਤੱਕ ਪੈਸੇ ਚਾਹੀਦੇ ਆ ਐਨਾ ਦੱਸੋ ਮੈਨੂੰ ਹਾਂਜੀ ਹਾਂਜੀ ਨਹੀਂ ਮੈਂ ਕੋਈ ਗੱਲ ਨਹੀਂ ਜ਼ਰੂਰ ਕਰਕੇ ਦੱਸੂਗਾ ਤੁਹਾਨੂੰ ਪੈਸੇ ਜਦੋਂ ਵੀ ਇੰਤਜਾਮ ਹੋ ਗਿਆ ਮੇਰੇ ਕੋਲੋਂ ਤਾਂ ਮੈਂ ਤੁਹਾਨੂੰ ਉਦੋਂ ਹੀ ਕੋਲ ਕਰਦੂੰਗਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਜ਼ਰੂਰ ਤੁਹਾਨੂੰ ਦੱਸੂਗਾ ਵੀ ਕਦੋਂ ਉਹ ਪੈਸਿਆ ਦਾ ਇੰਤਜਾਮ ਹੁੰਦਾ ਬੇਸ਼ੱਕ ਮੈਨੂੰ ਆਪਣਾ ਘਰ 'ਤੇ ਲੋਨ ਲੈਣਾ ਪੈ ਜੇ ਮੈਂ ਫਿਰ ਵੀ ਤੁਹਾਨੂੰ ਇੰਤਜਾਮ ਕਰਕੇ ਦਊਂਗਾ ਕੋਈ ਨਹੀਂ ਓਕੇ ਜੀ ਓਕੇ ਕੋਈ ਗੱਲ ਨਹੀਂ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਕਰੂੰਗਾ ਜੀ ਮੈਂ ਜ਼ਰੂਰ ਕਰੂੰਗਾ ਠੀਕ ਹੈ ਜੀ ਓਕੇ